ਸਤਿ ਸ਼੍ਰੀ ਅਕਾਲ ਜੀ ਕੂੜਾ ਪ੍ਰਬੰਧਨ ਕੰਪਨੀ ਤੋਂ ਗੱਲ ਕਰ ਰਹੇ ਹੋ ਅਸੀਂ ਤੁਹਾਨੂੰ ਦੱਸਨਾ ਚਾਹੁੰਦੇ ਹਾਂ ਕਿ ਅਸੀਂ ਪਿੰਡ ਲਾਲੋਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਗੱਲ ਕਰ ਰਹੇ ਹਾਂ ਸਾਡੇ ਪਿੰਡ ਦੀ ਜੋ ਕਮਿਊਨਿਟੀ ਹੈ ਉਸ ਨੇ ਇੱਕ ਸਫਾਈ ਪ੍ਰੋਗਰਾਮ ਆਯੋਜਿਤ ਕੀਤਾ ਸੀ ਉਸ ਵਿੱਚ ਅਸੀਂ ਲਗਭਗ ਦੋ ਤਿੰਨ ਦਿਨਾਂ ਵਿੱਚ ਪੂਰੇ ਪਿੰਡ ਦਾ ਜੋ ਵੀ ਮਲਬਾ ਸੀ ਰਹਿੰਦ ਖੂੰਹਦ ਸੀ ਉਹ ਸਾਰੀ ਇਕੱਠੀ ਕੀਤੀ ਹੈ ਅਤੇ ਹੁਣ ਅਸੀਂ ਉਸ ਮਲਬੇ ਦੀ ਰਹਿੰਦ ਖੂੰਹਦ ਦਾ ਨਿਪਟਾਰਾ ਕਰਨਾ ਚਾਹੁੰਦੇ ਹਾਂ ਸਾਨੂੰ ਇਸ ਦੇ ਨਿਪਟਾਰੇ ਦੀ ਬਹੁਤ ਜ਼ਰੂਰਤ ਹੈ ਅਤੇ ਅਸੀਂ ਆਪਣੇ ਪਿੰਡ ਵਿੱਚ ਬਿਲਕੁਲ ਸਫਾਈ ਅਤੇ ਸਹੀ ਸਾਫ਼ ਸਫਾਈ ਯਕੀਨੀ ਬਣਾਉਣਾ ਚਾਹੁੰਦੇ ਹਾਂ ਅਤੇ ਜੋ ਇਹ ਥੋਕ ਕੂੜਾ ਅਸੀਂ ਇਕੱਠਾ ਕੀਤਾ ਹੈ ਇਸਨੂੰ ਚੁਕਵਾਉਣਾ ਚਾਹੁੰਦੇ ਹਾਂ ਤੁਹਾਡੀ ਜੋ ਕੂੜਾ ਪ੍ਰਬੰਧਨ ਕਮੇ ਕੰਪਣੀ ਹੈ ਉਹ ਆ ਕੇ ਸਾਡੇ ਪਿੰਡ ਕੂੜਾ ਚੁੱਕ ਸਕਦੀ ਹੈ ਜੀ ਸਾਨੂੰ ਬਹੁਤ ਜ਼ਰੂਰਤ ਹੈ ਜੀ ਕੂੜਾ ਚੁਕਵਾਉਣ ਦੀ ਜੋ ਇਹ ਥੋਕ ਕੂੜਾ ਇਕੱਠਾ ਕੀਤਾ ਹੈ ਇਸ ਨਾਲ ਜੇਕਰ ਇਹ ਇਕੱਠਾ ਕੀਤਾ ਹੀ ਪਿਆ ਰਹਿ ਗਿਆ ਸਾਡੇ ਪਿੰਡ 'ਚ ਇਸ ਨਾਲ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਇਹ ਹਵਾ ਵਿੱਚ ਘੁਲ ਕੇ ਪ੍ਰਦੂਸ਼ਣ ਕਰ ਰਿਹਾ ਹੈ ਅਤੇ ਜੋ ਉਹ ਇਸ ਨਾਲ ਸਾਹ ਦੀਆਂ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ ਇਸ ਲਈ ਜੋ ਇਹ ਮਲਬਾ ਹੈ ਅਤੇ ਕੂੜਾ ਹੈ ਜੋ ਵੀ ਰਹਿੰਦ ਖੂੰਹਦ ਹੈ ਇਸ ਥੋਕ ਕੂੜੇ ਨੂੰ ਜਲਦੀ ਤੋਂ ਜਲਦੀ ਚੁੱਕਿਆ ਜਾਵੇ ਕੀ ਤੁਸੀਂ ਕੱਲ੍ਹ ਸਵੇਰੇ ਦਸ ਵਜੇ ਆ ਕੇ ਸਾਡੇ ਪਿੰਡ ਦਾ ਇਹ ਜੋ ਵੀ ਮਲਬਾ ਹੈ ਇਸ ਨੂੰ ਚੱਕ ਲਓ ਸਾਡਾ ਪਿੰਡ ਜੀ ਲਾਲੋਵਾਲੀ ਹੈ ਜੀ ਦੁਬਾਰਾ ਦੱਸ ਰਿਹਾ ਤੁਸੀਂ ਆ ਕੇ ਇਸ ਕੂੜੇ ਦਾ ਨਿਪਟਾਰਾ ਕਰ ਦਿਓ ਤਾਂ ਜੋ ਸਾਡੇ ਪਿੰਡ ਸਾਫ਼ ਸਫਾਈ ਬਣੀ ਰਹੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵਾਂਗਾ ਅਤੇ ਇਹ ਜਲਦੀ ਤੋਂ ਜਲਦੀ ਇਸ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ ਤਾਂ ਜੋ ਸਾ ਅਸੀਂ ਪਿੰਡ ਵਿੱਚ ਸਫਾਈ ਬਣਾਈ ਰੱਖੀਏ ਬਹੁਤ ਬਹੁਤ ਧੰਨਵਾਦ ਕੱਲ੍ਹ ਸਮੇਂ ਸਿਰ ਆ ਕੇ ਕੂੜਾ ਉਠਾ ਜਾਣਾ ਤਾਂ ਜੋ ਸਾਡੇ ਪਿੰਡ ਸਾਫ਼ ਸੁਥਰਾ ਬਣਿਆ ਰਹੇ